ਮੈਂ ਆਨਲਾਈਨ ਸ਼ੋਪਿੰਗ ਐਪ ਤੋਂ ਇੱਕ ਕੁੜਤਾ ਮੰਗਵਾਇਆ ਸੀ ਜਿਸ ਦਾ ਕੱਪੜਾ ਬਹੁਤ ਹੀ ਵਧੀਆ ਸੀ ਰੰਗ ਵੀ ਜਮਾਂ ਉੱਦਾਂ ਹੀ ਸੀ ਸਾਈਜ਼ ਦੀ ਗੱਲ ਕਰੀਏ ਤਾਂ ਸਾਈਜ਼ ਵੀ ਬਿਲਕੁਲ ਸਹੀ ਸੀ ਉਸਨੂੰ ਧੋਤਿਆਂ ਵੀ ਬਿਲਕੁਲ ਬਦਲਾਵ ਨਹੀਂ ਆਇਆ ਨਾ ਉਸਨੇ ਰੰਗ ਛੱਡਿਆ ਅਤੇ ਨਾ ਉਹ ਖੁੱਲ੍ਹਾ ਜਾਂ ਤੰਗ ਹੋਇਆ ਉਸ ਦਾ ਕੱਪੜਾ ਰਿਓਨ ਸੀ ਮੈਂ ਇਸ ਪ੍ਰੋਡਕਟ ਤੋਂ ਬਹੁਤ ਹੀ ਖੁਸ਼ ਹਾਂ ਜਿਵੇਂ ਦਾ ਕੁੜਤਾ ਮੈਂ ਚਾਹੁੰਦੀ ਸੀ ਉਵੇਂ ਦਾ ਮੈਨੂੰ ਮਿਲ ਗਿਆ ਨਾ ਮੈਨੂੰ ਬਾਜ਼ਾਰ ਜਾਣ ਦੀ ਲੋੜ ਪਈ ਮੈਨੂੰ ਘਰ ਬੈਠਿਆਂ ਹੀ ਮੇਰਾ ਮਨ ਭਾਉਂਦਾ ਕੁੜਤਾ ਮਿਲ ਗਿਆ ਮੈਂ ਇਸ ਪ੍ਰੋਡਕਟ ਤੋਂ ਬਹੁਤ ਖੁਸ਼ ਹਾਂ ਮੈਂ ਓਨਲਾਈਨ ਸ਼ੋਪਿੰਗ ਐਪ ਵਾਲਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਹਨਾਂ ਨੇ ਇਹ ਕੰਮ ਸੌਖਾ ਕਰ ਦਿੱਤਾ ਹੈ ਕਿ ਘਰ ਬੈਠਿਆਂ ਹੀ ਲੋਕਾਂ ਨੂੰ ਉਹਨਾਂ ਦਾ ਮਨ ਭਾਉਂਦਾ ਸਮਾਨ ਮਿਲ ਜਾਂਦਾ ਹੈ